ਸਾਡੇ ਸਥਾਨ ਦੇ ਸਥਾਨਕ ਕਲਾਵਾਂ ਅਤੇ ਕਾਰੀਗਰਾਂ ਦੀ ਸਹਾਇਤਾ ਲਈ ਸਰਕਾਰ ਦੁਆਰਾ ਬਹੁਤ ਹੀ ਪਹਿਲਕਦਮ ਚੁੱਕੇ ਗਏ ਹਨ ਜਿਵੇਂ ਕਿ ਕਰਜ਼ੇ ਸਬਸਿਡੀਆਂ ਫੰਡਿੰਗ ਆਦਿ ਜਿਵੇਂ ਕਿ ਹੁਣ ਸਰਕਾਰ ਨੇ ਵਾਧੂ ਸਬਸਿਡੀਆਂ ਲਗਾ ਰੱਖੀਆ ਹਨ ਕਿਸਾਨਾਂ ਨੂੰ ਦੇਣ ਵਾਸਤੇ ਜਿਵੇਂ ਕਿ ਸਿਲੰਡਰ ਉੱਤੇ ਕਿ ਤਾਂ ਕਿ ਉਹ ਆਪਦਾ ਪੇਟ ਭਰ ਸਕਣ ਅਤੇ ਉਹਨਾਂ ਦੇ ਖਰਚੇ ਘੱਟ ਹੋਣ ਪਰ ਫਿਰ ਵੀ ਅੱਜ ਕੱਲ੍ਹ ਬਹੁਤ ਹੀ ਇਹੋ ਜਿਹੀਆਂ ਕਲਾ ਕਿਸਮਾਂ ਹਨ ਜਿਹਨਾਂ ਨੂੰ ਵਧੇਰੇ ਮਹਾਨਤਾ ਦੀ ਲੋੜ ਹੈ ਜਿਵੇਂ ਸਾਡਾ ਪੰਜਾਬੀ ਸੱਭਿਆਚਾਰ ਉਹ ਹੌਲੀ ਹੌਲੀ ਕਰਕੇ ਅਲੋਪ ਹੁੰਦਾ ਜਾ ਰਿਹਾ ਅੱਜ ਕੱਲ੍ਹ ਦੇ ਜਵਾਕਾਂ ਨੂੰ ਜ਼ਿਆਦਾ ਨਹੀਂ ਪਤਾ ਇਹਨਾਂ ਬਾਰੇ ਤਾਂ ਜੋ ਸਰਕਾਰ ਨੂੰ ਇਹ ਚਾਹੀਦਾ ਕਿ ਉਹ ਇਹਨਾਂ ਬਾਰੇ ਜੁਆਕਾਂ ਨੂੰ ਦੱਸੇ ਤਾਂ ਕਿ ਉਹ ਆਪ ਤਾਂ ਕਿ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਕੁਛ ਨਾ ਕੁਛ ਦੱਸ ਸਕਣ ਜਿਵੇਂ ਕਿ ਪੀੜੀ ਪਰਾਂਦਾ ਮੰਜੇ ਇਹਨਾਂ ਚੀਜ਼ਾਂ ਦੀ ਅੱਜਕੱਲ੍ਹ ਬਹੁਤ ਹੀ ਘੱਟ ਵਰਤੋਂ ਹੋ ਰਹੀ ਹੈ ਤਾਂ ਜੋ ਜੋ ਬੱਚਿਆਂ ਨੂੰ ਇਹਨਾਂ ਬਾਰੇ ਨਹੀਂ ਪਤਾ ਇਸ ਕਰਕੇ ਸਰਕਾਰ ਨੂੰ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਉਪਚਾਰ ਕਰਨਾ ਚਾਹੀਦਾ ਹੈ ਅਤੇ ਸਾਡੇ ਨੌਜਵਾਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਵੀ ਦੱਸਣਾ ਚਾਹੀਦਾ ਹੈ